ਹੈਲੋ ਹਾਂਜੀ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਹਾਂਜੀ ਮੈਂ ਨਾ ਕੁਝ ਸਮੇਂ ਪਹਿਲਾਂ ਤੁਹਾਡੇ ਸਾਈਡ ਤੋਂ ਦੋ ਪ੍ਰੋਡਕਟ ਔਡਰ ਕੀਤੇ ਸੀ ਜਿਹੜਾ ਮੇਰਾ ਪਹਿਲਾ ਪ੍ਰੋਡਕਟ ਸੀ ਉਹਦਾ ਤਾਂ ਤਜਰਬਾ ਬਹੁਤ ਵਧੀਆ ਰਿਹਾ ਪਰ ਅੱਜ ਮੈਂ ਤੁਹਾਨੂੰ ਆਪਣੇ ਦੂਜੇ ਪ੍ਰੋਡੈਕਟ ਦਾ ਤਜਰਬਾ ਦੱਸਣਾ ਚਾਹੂੰਗੀ ਜਿਹੜਾ ਦੂਜਾ ਪ੍ਰੋਡੈਕਟ ਸੀ ਉਹ ਮੈਂ ਕੁੜਤਾ ਮੰਗਵਾਇਆ ਸੀ ਤੁਹਾਡੀ ਸਾਈਟ ਤੋਂ ਪਹਿਲਾਂ ਤਾਂ ਮੈਂ ਉਹ ਕੁੜਤਾ ਬਾਜ਼ਾਰ 'ਚ ਵੇਖਦੀ ਰਹੀ ਪਰ ਉਹ ਮੈਨੂੰ ਨਹੀਂ ਮਿਲਿਆ ਪਰ ਜਦੋਂ ਮੈਂ ਤੁਹਾਡੀ ਸਾਈਟ 'ਤੇ ਦੇਖਿਆ ਤਾਂ ਉਹ ਮੈਨੂੰ ਬਹੁਤ ਹੀ ਘੱਟ ਰੇਟ 'ਤੇ ਮਿਲਿਆ ਅਤੇ ਉਹਦਾ ਰੰਗ ਵੀ ਬਹੁਤ ਸੋਹਣਾ ਸੀ ਅਤੇ ਮੈਂ ਉਹਦਾ ਰੰਗ ਵੇਖ ਕੇ ਉਹਨੂੰ ਜਿਹੜਾ ਕਿ ਔਡਰ ਕਰ ਲਿਆ ਮੈਂ ਆਪਣਾ ਸਾਈਜ਼ ਵੀ ਸੇਮ ਹੀ ਔਡਰ ਕੀਤਾ ਸੀ ਪਰ ਜਦੋਂ ਮੈਂ ਆਪਣਾ ਔਡਰ ਪ੍ਰਾਪਤ ਕੀਤਾ ਅਤੇ ਜਦੋਂ ਮੈਂ ਉਹਦੀ ਫਿਟਿੰਗ ਦੇਖੀ ਤਾਂ ਉਹ ਬਹੁਤ ਹੀ ਖ਼ਰਾਬ ਫਿਟਿੰਗ ਸੀ ਉਹ ਸਾਈਜ਼ ਬਹੁਤ ਹੀ ਅਲੱਗ ਸੀ ਮੇਰੇ ਸਾਈਜ਼ ਨਾਲੋਂ ਕਿਉਂਕਿ ਜਿਹੜਾ ਮੈਂ ਸਾਈਜ਼ ਮੰਗਵਾਇਆ ਸੀ ਉਹ ਤਾਂ ਆਇਆ ਹੀ ਨਹੀਂ ਮੈਨੂੰ ਅਤੇ ਜਿਹੜਾ ਰੰਗ ਸੀ ਉਹ ਫੋਟੋ ਨਾਲੋਂ ਬਹੁਤ ਹੀ ਅਲੱਗ ਸੀ ਜਿਹੜਾ ਰੰਗ ਸੀ ਉਹ ਥੋੜ੍ਹਾ ਮੈਨੂੰ ਬਹੁਤ ਹੀ ਗਾੜਾ ਆ ਗਿਆ ਅਤੇ ਜਿਹੜਾ ਫੋਟੋ 'ਚ ਸੀ ਉਹ ਬਹੁਤ ਹੀ ਫਿੱਕਾ ਸੀ ਅਤੇ ਇਸ ਸੰਬੰਧ ਵਿੱਚ ਜਿਹੜਾ ਮੇਰਾ ਤਜਰਬਾ ਸੀ ਉਹ ਬਹੁਤ ਹੀ ਖ਼ਰਾਬ ਰਿਹਾ ਅਤੇ ਜਿਹੜੀ ਮੇਰੀ ਫਿਟਿੰਗ ਸੀ ਉਹ ਤਾਂ ਇੰਨੀ ਖ਼ਰਾਬ ਹੋ ਗਈ ਕਿ ਮੈਨੂੰ ਕੁੜਤਾ ਜੱਚਿਆ ਹੀ ਨਹੀਂ ਅਤੇ ਮੈਂ ਤੁਹਾਨੂੰ ਇਹ ਆਪਣਾ ਤਜਰਬਾ ਦੱਸੂੰਗੀ ਕਿ ਜਿਹੜਾ ਮੇਰਾ ਬਹੁਤ ਹੀ ਖ਼ਰਾਬ ਰਿਹਾ ਅਤੇ ਤੁਸੀਂ ਇਸ ਵੱਲ ਆਪਣਾ ਧਿਆਨ ਦਿਓ ਅਤੇ ਜਿਹੜਾ ਕਿ ਤੁਹਾਡੀ ਜਿਹੜੀ ਸਾਈਟ ਦਾ ਨਾਮ ਜਿਹੜਾ ਹੈ ਉਹ ਖ਼ਰਾਬ ਨਾ ਹੋਵੇ ਅਤੇ ਮੈਂ ਅੱਗੇ ਅ ਹੋਰ ਵੀ ਜਾਣਿਆਂ ਨੂੰ ਦੱਸੂੰਗੀ ਜਦੋਂ ਇਹ ਤੁਹਾਡੇ ਜਦੋਂ ਮੇਰਾ ਤਜਰਬਾ ਵਧੀਆ ਹੋਊਗਾ ਸੋ ਤੁਸੀਂ ਆਪਣੇ ਜਿਹੜੇ ਪ੍ਰੋਡੈਕਟ ਆ ਉਹ ਵਧੀਆ ਭੇਜਿਆ ਕਰੋ ਪਰ ਜਿਹੜਾ ਮੇਰੇ ਦੂਜੇ ਪ੍ਰੋਡੈਕਟ ਦਾ ਤਜਰਬਾ ਉਹ ਬਹੁਤ ਹੀ ਖ਼ਰਾਬ ਰਿਹਾ